ਵੱਖ ਵੱਖ ਧਰਮਾਂ ਦਾ ਰਹਿਣ ਸਹਿਣ ਪ੍ਰਾਰਥਨਾ ਤੀਰਥ ਸਥਾਨ ਰਸਮ ਰਿਵਾਜ਼ ਵੱਖ ਵੱਖ ਹੁੰਦੇ ਨੇ ਜਿਵੇਂ ਕਿ ਹਿੰਦੂ ਧਰਮ ਹਿੰਦੂ ਧਰਮ ਮੰਦਰਾਂ ਵਿੱਚ ਪੂਜਾ ਕੀਤੀ ਜਾਂਦੀ ਹੈ ਨਾ ਮੂਰਤੀਆਂ ਹੁੰਦੀਆਂ ਨੇ ਭਗਵਾਨ ਦੀਆਂ ਉੱਥੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਆ ਪ੍ਰਸ਼ਾਦ ਵੰਡੇ ਜਾਂਦੇ ਹਨ ਭਜਨ ਗਾਏ ਜਾਂਦੇ ਹਨ ਇਹ ਹਿੰਦੂ ਧਰਮ ਦਾ ਹੈ ਮੁਸਲਿਮ ਧਰਮ ਆ ਉਹਨਾਂ ਦੇ ਪੰਜ ਨਮਾਜ਼ਾਂ ਦੀਆਂ ਅਦਾ ਕੀਤੀਆਂ ਜਾਂਦੀਆਂ ਹਨ ਉਹਨਾਂ ਦੀ ਮਸੀਤ ਹੁੰਦੀ ਹੈ ਕੁਰਾਨ ਸ਼ਰੀਫ ਪੜ੍ਹਿਆ ਜਾਂਦਾ ਉਹਨਾਂ ਦਾ ਅਲੱਗ ਅਲੱਗ ਹੁੰਦਾ ਜਿਹੜਾ ਮਲੇਰਕੋਟਲਾ ਵਿਖੇ ਸਥਾਨ ਬਣਿਆ ਹੋਇਆ ਹੈ ਜਿੱਥੇ ਮਤਲਬ ਉਹਨਾਂ ਨੂੰ ਮਤਲਬ ਪ੍ਰਸ਼ਾਦ ਭੇਟ ਕੀਤਾ ਜਾਂਦਾ ਨਾ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਆ ਇਹ ਅਲੱਗ ਅਲੱਗ ਧਾਰਮਿਕ ਸਥਾਨਾਂ ਦੇ ਹੁੰਦਾ ਸਿੱਖ ਧਰਮ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਸਿੱਖਾਂ ਨੂੰ ਮਤਲਬ ਅਲੱਗ ਤਰੀਕੇ ਨਾਲ ਦਿਸਣ ਉਹਨਾਂ ਦੀ ਰਹਿਤ ਮਰਿਆਦਾ ਡਿਫਾਈਨ ਕੀਤੀ ਆ ਕਿ ਸਿੱਖ ਧਰਮ ਕੰਘਾ ਕੇਸ ਕੜਾ ਕਰਪਾਨ ਪੰਜ ਕਕਾਰ ਧਾਰਨ ਕਰਨ ਕਿ ਸਿੱਖ ਦਾ ਮਤਲਬ ਦੂਰੋਂ ਦੇਖ ਕੇ ਪਤਾ ਲੱਗ ਜੇ ਕੇ ਇਹ ਸਿੱਖ ਆ ਰਹੇ ਨੇ ਅਤੇ ਉਹ ਉਹਨਾਂ ਨੂੰ ਮਤਲਬ ਨਸ਼ਾ ਨਾ ਕਰਨਾ ਸੱਚ ਬੋਲਣਾ ਮਾੜੇ 'ਤੇ ਵਾਰ ਨਾ ਕਰਨਾ ਇਹ ਵੀ ਸਿੱਖ ਧਰਮ ਵਿੱਚ ਦੱਸਿਆ ਹੋਇਆ ਹੈ ਅਲੱਗ ਅਲੱਗ ਮਤਲਬ ਮੱਸਿਆ ਲੋਹੜੀ ਦੀਵਾਲੀ 'ਤੇ ਮਤਲਬ ਧਾਰਮਿਕ ਤੀਰਥ ਸਥਾਨਾਂ 'ਤੇ ਜਾਇਆ ਜਾਂਦਾ ਹੈ ਸਿੱਖ ਧਰਮ ਵਿੱਚ ਪੰਜਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਸੁਬਹਾ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਪ੍ਰਸ਼ਾਦ ਬਣਾਇਆ ਜਾਂਦਾ ਹੈ ਜਿਹਨਾਂ ਨੂੰ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ ਗੁਰੂ ਕਾ ਲੰਗਰ ਲਾਇਆ ਜਾਂਦਾ ਹੈ ਜਿੱਥੇ ਕੋਈ ਵੀ ਚੌਵੀ ਘੰਟੇ ਲੰਗਰ ਚੱਲਦਾ ਕਦੋਂ ਵੀ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ ਅਤੇ ਗੁਰੂ ਦੇ ਘਰ ਤੋਂ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਅਤੇ ਇਹ ਧਾਰਮਿਕ ਮਰਿਆਦਾ ਨੂੰ ਬਹੁਤ ਮੰਨਿਆ ਜਾਂਦਾ ਹੈ ਅਤੇ ਇਹ ਸਟਰਿਕਲੀ ਫੋਲੋ ਕੀਤੀਆਂ ਜਾਂਦੀਆਂ ਨੇ ਇਹ ਚੀਜ਼ਾਂ